ਭਾਰਤ ਵਿੱਚ ਮਨੋਰੰਜਨ ਦੇ ਸਾਧਨਾਂ ਦਾ ਬਹੁਤ ਲੰਬੇ ਸਮੇਂ ਤੋਂ ਵਿਕਾਸ ਹੁੰਦਾ ਆਇਆ ਹੈ ਸ਼ੁਰੂ ਸ਼ੁਰੂ ਵਿੱਚ ਲੋਕਾਂ ਦੁਆਰਾ ਲੋਕਾਂ ਦਾ ਹੀ ਮਨੋਰੰਜਨ ਕੀਤਾ ਜਾਂਦਾ ਸੀ ਅਲੱਗ ਅਲੱਗ ਤਰ੍ਹਾਂ ਦੇ ਨਾਟਕ ਜਾਂ ਨਾਟਸ਼ਾਲਾਵਾਂ ਦੁਆਰਾ ਜਾਂ ਰਾਸ ਲੀਲਾ ਦੁਆਰਾ ਲੋਕਾਂ ਦੇ ਮਨੋਰੰਜਨ ਦੇ ਸਾਧਨ ਮਿਲਦੇ ਸਨ ਖੇਡਾਂ ਜਾਂ ਬਾਜ਼ੀਗਰਾਂ ਦੁਆਰਾ ਬਾਜ਼ੀਆਂ ਪਾਈ ਜਾਣ ਵਾਲੀਆਂ ਵੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਸਨ ਉਸ ਤੋਂ ਇਲਾਵਾ ਆਮ ਤੌਰ 'ਤੇ ਪਿੰਡਾਂ ਵਿੱਚ ਅਖਾੜੇ ਜਾਂ ਨਾਚ ਗਾਉਣ ਵਾਲੀਆਂ ਦੇ ਅਖਾੜੇ ਲਗਾ ਕੇ ਲੋਕਾਂ ਦਾ ਮਨੋਰੰਜਨ ਹੁੰਦਾ ਆਇਆ ਹੈ ਉਸ ਤੋਂ ਬਾਅਦ ਟੀ ਵੀ ਅਤੇ ਸਿਨੇਮਾ ਦੁਆਰਾ ਮਨੋਰੰਜਨ ਦੇ ਸਾਧਨਾਂ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਅੱਜ ਕੱਲ੍ਹ ਸਮਾਜ ਦੇ ਅਲੱਗ ਅਲੱਗ ਵਰਗਾਂ ਦੁਆਰਾ ਅਲੱਗ ਅਲੱਗ ਤਰ੍ਹਾਂ ਦੇ ਮਨੋਰੰਜਨ ਦੇ ਸਾਧਨਾਂ ਦਾ ਵਰਤੋਂ ਕੀਤੀ ਜਾਂਦੀ ਹੈ ਸਮਾਜ ਦੇ ਅਲੱਗ ਅਲੱਗ ਤਬਕੇ ਦੁਆਰਾ ਜਾਂ ਅਲੱਗ ਅਲੱਗ ਉਮਰ ਵਰਗ ਦੇ ਲੋਕਾਂ ਦੁਆਰਾ ਅਲੱਗ ਅਲੱਗ ਤਰ੍ਹਾਂ ਦੀਆਂ ਫਿਲਮਾਂ ਜਾਂ ਨਾਟਕ ਜਾਂ ਟੀ ਵੀ ਲੜੀਵਾਰਾਂ ਦਾ ਵਰਤੋਂ ਕੀਤੀ ਜਾਂਦੀ ਹੈ